ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਕੋਰਸ ਦੀ ਟ੍ਰੇਨਿੰਗ ਦਿੰਦੇ ਹੋ ਜੀ ਮੈਮ ਮੈਂ ਹਾਂਜੀ ਮੈਮ ਮੈਂ ਪੁਨੀਤ ਹਾਂ ਜੀ ਮੈਂ ਇੱਥੇ ਹੀ ਰਹਿੰਦੀ ਹਾਂ ਜੀ ਸਾਡੇ ਕਈ ਇੱਥੋਂ ਮਤਲਬ ਘਰਾਂ ਦਿਆਂ 'ਚੋਂ ਜਵਾਕ ਆਉਂਦੇ ਆ ਤੁਹਾਡੇ ਕੋਲ ਟ੍ਰੇਨਿੰਗ ਲੈਣ ਫੁੱਟਬਾਲ ਦੀ ਮੈਂ ਮੇਰਾ ਵੀ ਮਨ ਕਰਦਾ ਜੀ ਫੁੱਟਬਾਲ ਖੇਡਣ ਨੂੰ ਮੈਂ ਸੋਚਦੀ ਹਾਂ ਮੈਂ ਵੀ ਤੁਹਾਡੇ ਕੋਲ ਟ੍ਰੇਨਿੰਗ ਲਈ ਆਇਆ ਕਰਾਂ ਤਾਂ ਤੁਸੀਂ ਸਿੱਖਾ ਦਿਉਂਗੇ ਮੈਮ ਤੁਸੀਂ ਮੈਨੂੰ ਜੀ ਮੈਮ ਤੁਹਾਡਾ ਅ ਅਡਰੈਸ ਜੀ ਓਕੇ ਮੈਮ ਫੀਸ ਜੀ ਅਤੇ ਟਾਈਮ ਮੈਮ ਅ ਹੋਰ ਕਿਵੇਂ ਮੈਮ ਵਧੀਆ ਜੀ ਮੈਮ ਜਿੰਮ ਲਾ ਲਿਆ ਕਰਾਂਗੇ ਜੀ ਨਾਲ ਮਤਲਬ ਫਿੱਟ ਰਹਿਣ ਲਈ ਅ ਮੈਮ ਫਿਜੀਕਲ ਐਕਸਰਸਾਈਜ਼ ਵੀ ਹੁੰਦੀਆਂ ਹੋਣਗੀਆਂ ਜੀ ਮੈਮ ਉਹ ਵੀ ਫਿਰ ਮੈਂ ਕਰ ਲਿਆ ਕਰੂੰਗੀ ਮੈਮ ਇੱਕ ਮੈਂ ਅ ਗੋਲਾ ਅਲੱਗ ਤੋਂ ਕੋਈ ਗੱਲ ਨਹੀਂ ਮੈਂ ਹਾਂਜੀ ਮੈਮ ਮੈਂ ਇੱਕ ਗੋਲਾ ਸੁੱਟਣ ਦੀ ਪ੍ਰੈਕਟਿਸ ਕਰਦੀ ਹੁੰਦੀ ਹਾਂ ਜੀ ਉਹ ਵੀ ਤੁਸੀਂ ਕਰਾ ਦਿਉਂਗੇ ਤਾਂ ਵਧੀਆ ਗੱਲ ਹੈ ਜੀ ਓਕੇ ਮੈਮ ਅਤੇ ਸਵੇਰੇ ਮੈਮ ਸਵੇਰੇ ਸਾਢੇ ਛੇ ਵਜੇ ਮੈਮ ਆਪਣੇ ਕੋਲੋਂ ਮੈਮ ਕਿੰਨਾ ਛੇ ਵਜੇ ਠੀਕ ਆ ਮੈਮ ਅ ਆਪਣੇ ਲਈ ਅ ਆਪਾਂ ਓਵਰ ਟਾਈਮ ਵੀ ਲਗਾ ਸਕਦੇ ਹਾਂ ਮੈਮ ਬਾਅਦ ਮੇਂ ਜੇ ਮਤਲਬ ਵੱਧ ਪ੍ਰੈਕਟਿਸ ਕਰਨੀ ਹੋਵੇ ਠੀਕ ਹੈ ਮੈਮ ਥੈਂਕ ਯੂ ਠੀਕ ਹੈ ਮੈਮ ਓਕੇ